ਜੇਕਰ ਅਸੀਂ ਸਟੇਟ ਦਾ ਟਰਾਂਸਪੋਰਟ ਸਿਸਟਮ ਦੇਖੀਏ ਤਾਂ ਸਾਡੇ ਇੱਥੇ ਲੇਡੀਜ਼ ਨੂੰ ਖਾਸ ਕਰ ਗਰਲਸ ਨੂੰ ਆਧਾਰ ਕਾਰਡ ਦੇ ਉੱਪਰ ਫਰੀ ਹੈ ਪੰਜਾਬ ਦੇ ਵਿੱਚ ਤਾਂ ਆਧਾਰ ਕਾਰਡ ਦਿਖਾ ਕੇ ਅਸੀਂ ਪੰਜਾਬ 'ਚ ਕਿਤੇ ਵੀ ਟਰੈਵਲ ਕਰ ਸਕਦੇ ਹਾਂ ਤਾਂ ਫਰੀ ਔਫ ਕੋਸਟ ਹੈ ਬਟ ਬਾਕੀ ਜੇਕਰ ਮੇਲ ਦਾ ਵੀ ਦੇਖੀਏ ਅਦਰ ਕਿਰਾਏ ਵਗੈਰਾ ਵੀ ਦੇਖੀਏ ਤਾਂ ਕੁਛ ਖਾਸ ਨਹੀਂ ਹੈ ਤਾਂ ਜਿਹੜੀ ਯਾਤਰਾ ਹੈ ਉਹ ਸਹੀ ਹੈ ਤਾਂ ਹੋਰ ਵੀ ਸੂਬਿਆਂ ਦੇ ਵਿੱਚ ਦੇਖੀਏ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਵੀ ਜਿਹੜਾ ਕਿਰਾਇਆ ਹੈ ਗਰਲਸ ਦਾ ਉਹ ਫਰੀ ਹੈ ਤਾਂ ਭਾਰਤ ਨੂੰ ਜਾਂ ਪੰਜਾਬ ਨੂੰ ਤਾਂ ਇੱਥੇ ਜਿਹੜਾ ਟਰਾਂਸਪੋਟ ਹੈ ਵੀ ਹੈ ਬਸਿਸ ਵਗੈਰਾ ਵੀ ਕਾਫੀ ਹੈ ਪ੍ਰਾਈਵੇਟ ਸੈਕਟਰ 'ਚ ਦੇਖ ਲਈਏ ਜਾਂ ਫਿਰ ਸਰਕਾਰੀ ਰੋਡਵੇਜ਼ ਵਗੈਰਾ ਦੇਖ ਲਈਏ ਉਹ ਹਰ ਇੱਕ ਸਟੇਟ ਦੇ ਵਿੱਚ ਬਹੁਤ ਬੈਟਰ ਪ੍ਰੋਸੀਡ ਕਰ ਰਹੀਆਂ ਨੇ